ਮੈਂ ਆਪਣੀ ਪੰਜਵੀਂ ਕਲਾਸ ਦੇ ਵਿੱਚ ਇੱਕ ਮੇਰੇ ਅਧਿਆਪਕ ਸਨ ਜਿਹਨਾਂ ਨੇ ਮੈਨੂੰ ਬਹੁਤ ਵਧੀਆ ਸਿਖਾਇਆ ਉਹਨਾਂ ਨੇ ਮੈਨੂੰ ਅੱਗੇ ਗਾਈਡ ਕੀਤਾ ਕਿ ਤੁਸੀਂ ਇਸ ਤਰ੍ਹਾਂ ਜਾਣਾ ਚਾਹੀਦਾ ਹੈ ਕਿ ਉਹ ਬਹੁਤ ਗਰੀਬ ਬੱਚਿਆਂ ਦੀ ਵੀ ਮਦਦ ਕਰਦੇ ਸਨ ਕਿ ਜਿਵੇਂ ਕੋਈ ਨਹੀਂ ਅਫੋਰਡ ਕਰ ਸਕਦਾ ਨਹੀਂ ਪੈਸੇ ਭਰ ਸਕਦਾ ਕਹਿੰਦੇ ਸੀ ਮੈਂ ਬੱਚਿਆਂ ਨੂੰ ਸਿਖਾਊਂਗੀ ਅਤੇ ਉਹਨਾਂ ਨੇ ਮੈਨੂੰ ਸ਼ੁਰੂ ਤੋਂ ਲੈ ਕੇ ਅਸੀਂ ਇੰਨੇ ਪੈਸੇ ਨਹੀਂ ਭਰ ਸਕਦੇ ਸੀ ਪਰ ਉਹਨਾਂ ਨੇ ਸਾਨੂੰ ਪੂਰੀ ਮਦਦ ਕਰਵਾਈ ਕਿ ਤੁਸੀਂ ਇੱਦਾਂ ਇੱਦਾਂ ਜਾਓ ਉਹਨਾਂ ਨੇ ਮੇਰਾ ਸਕੂਲ ਤੋਂ ਬਾਅਦ ਵੀ ਇੰਨੀ ਮਦਦ ਕੀਤੀ ਇੰਨੇ ਬੱਚਿਆਂ ਦੀ ਮਦਦ ਕੀਤੀ ਜਿਸ ਨਾਲ ਸਾਡੀ ਬਹੁਤ ਮਦਦ ਮਿਲੀ ਸਾਨੂੰ ਅਤੇ ਇੰਨੀ ਵਧੀਆ ਉਹਨਾਂ ਨੇ ਹੱਥ 'ਚ ਉਹਨਾਂ ਦੇ ਕਲਾ ਅਤੇ ਆਰਟ ਹੈ ਜਿਸਨੂੰ ਦੇਖ ਕੇ ਮਨ ਆਕਰਸ਼ਿਤ ਹੋ ਜਾਂਦਾ ਅਤੇ ਮੈਂ ਇੱਕ ਨੇਲ ਆਰਟ ਵੀ ਆਰਟ ਵੀ ਕਰਦੀ ਹਾਂ ਜਿਹਦੇ ਉੱਤੇ ਮੈਂ ਆਪਣੀ ਚਿੱਤਰਤਾ ਚਿੱਤਰਕਾਰ ਆਰਟ ਸਾਰਾ ਕੁਛ ਦਿਖਾਉਂਦੀ ਹਾਂ ਅਤੇ ਮੈਂ ਸਿਖਾਉਂਦੀ ਵੀ ਹਾਂ ਅੱਗੇ ਜੇ ਕੋਈ ਨਹੀਂ ਦੇ ਸਕਦਾ ਪੈਸੇ ਮੈਂ ਉਹਨਾਂ ਨੂੰ ਫਰੀ 'ਚ ਵੀ ਸਿਖਾਉਂਦੀ ਹਾਂ ਕਿ ਸਭ ਨੂੰ ਵਧੀਆ ਆਉਣਾ ਚਾਹੀਦਾ